ਸਤਿ ਸ਼੍ਰੀ ਅਕਾਲ ਸਰ ਮੈਂ ਤੁਹਾਡੀ ਕੰਪਨੀ ਤੋਂ ਫ਼ੋਨ ਖਰੀਦਿਆ ਸੀ ਤੇ ਬਹੁਤ ਹੀ ਵਧੀਆ ਨਿਕਲ਼ਿਆ ਅਤੇ ਇਸ ਵਿੱਚ ਬਹੁਤ ਸਾਰੇ ਨਵੇਂ ਨਵੇਂ ਐਪਸ ਅਤੇ ਇਸ ਦੀ ਕੁਇ ਕੈਮਰਾ ਕੁਆਲਿਟੀ ਵੀ ਬਹੁਤ ਹੀ ਵਧੀਆ ਹੈ ਇਸਦਾ ਸਪੀਕਰ ਬਹੁਤ ਹੀ ਵਧੀਆ ਹੈ ਤੇ ਵਧੀਆ ਆਵਾਜ